ਮੈਂ ਆਪਣੇ ਰਾਜੇਯ ਤੋਂ ਬਾਹਰ ਜਿਹੜੇ ਦੇ ਰਾਜੇਯ 'ਚ ਯਾਤਰਾ ਕੀਤੀ ਆ ਉਹ ਕੇ ਉੱਤਰਾਖੰਡ ਉਤਰਾਖੰਡ ਆਪਾਂ ਮੰਨਸੂਰੀ ਗਏ ਸੀ ਅਤੇ ਮਨਸੂਰੀ ਜਿਸ ਤਰ੍ਹਾਂ ਕਹਿਣਾ ਚਾਹੋ ਤਾਂ ਬਹੁਤ ਪਹਾੜੀ ਇਲਾਕਾ ਹੈ ਅਤੇ ਉਥੇ ਪਹਾੜਾਂ ਦਾ ਮੇਨ ਵੀ ਮੌਸਮ ਕਰਕੇ ਲੋਕੀ ਬਹੁਤ ਜਾਂਦੇ ਆ ਮਸੂਰੀ ਇੱਕ ਇਹੋ ਜਿਹੀ ਜਗ੍ਹਾ ਹੈ ਆਪਾਂ ਉੱਥੇ ਹਫ਼ਤਾ ਕੁ ਰਹੇ ਹਾਂ ਅਤੇ ਮਨਸੂਰੀ ਇਹੋ ਜਿਹੀ ਜਗ੍ਹਾ ਹੈ ਜੋ ਕਿ ਮੇਨਲੀ ਮੌਸਮ ਕਰਕੇ ਬਹੁਤ ਫੇਮਸ ਹੈ ਉੱਥੇ ਜਾ ਕੇ ਇੰਨਾਂ ਆਨੰਦ ਆਉਂਦਾ ਹੈ ਇੰਨਾ ਖੁਸ਼ੀ ਅਤੇ ਇੰਨਾ ਵਧੀਆ ਮੌਸਮ ਹੁੰਦਾ ਕਿ ਸਾਡਾ ਦਿਲ ਕਰਦਾ ਹੈ ਕਿ ਆਪਾਂ ਥੋੜ੍ਹੇ ਦਿਨ ਉਹ ਹੋਰ ਰਹਿ ਲਈਏ ਉਥੋਂ ਦਾ ਮੌਸਮ ਸਭ ਤੋਂ ਜ਼ਿਆਦਾ ਵਧੀਆ ਹੈਗਾ ਉਥੋਂ ਦਾ ਖਾਣ ਪੀਣ ਜੋ ਕਿ ਅੰਮ੍ਰਿਤਸਰ ਤੋਂ ਵੀ ਜ਼ਿਆਦਾ ਬਹੁਤ ਵਧੀਆ ਹੈਗਾ ਉੱਥੇ ਦੇ ਚੀਜ਼ਾਂ ਬਹੁਤ ਜ਼ਿਆਦਾ ਸਵਾਦ ਬਹੁਤ ਕਹਿ ਲਓ ਟੇਸਟੀ ਇਥੋਂ ਅੰਮ੍ਰਿਤਸਰ ਦੇ ਖਾਣ ਪੀਣ ਨਾਲੋਂ ਵੀ ਬਹੁਤ ਜ਼ਿਆਦਾ ਆਪਾਂ ਉਥੋਂ ਦੀ ਪੂੜੀ ਛੋਲੇ ਖਾਧੇ ਆ ਭਟੂਰੇ ਛੋਲੇ ਖਾਧੇ ਆ ਗੋਲ ਗੱਪੇ ਖਾਧੇ ਆ ਟਿੱਕੀ ਹੈਗੀ ਜੋ ਕਿ ਹਰ ਇੱਕ ਚੀਜ਼ ਬਹੁਤ ਜ਼ਿਆਦਾ ਸਵਾਦ ਹੈਗੀ ਸੀ ਉਥੋਂ ਦੇ ਵਾਤਾਵਰਨ ਉਥੋਂ ਦਾ ਮਾਹੌਲ ਉਥੋਂ ਦੀ ਸੜਕਾਂ ਉਥੋਂ ਦਾ ਮੌਸਮ ਬਹੁਤ ਜ਼ਿਆਦਾ ਹੀ ਵਧੀਆ ਸੀ ਅਤੇ ਉੱਥੇ ਆਪਾਂ ਹਰ ਇੱਕ ਦਿਨ ਬਹੁਤ ਜ਼ਿਆਦਾ ਇੰਜੋਏ ਕੀਤਾ ਹੈ ਬਹੁਤ ਜ਼ਿਆਦਾ ਵਧੀਆ ਸੀ ਅਤੇ ਉੱਤਰਾਖੰਡ 'ਚ ਜਿਹੜਾ ਮੰਸੂਰੀ ਹੈਗਾ ਉਹ ਬਹੁਤ ਵਧੀਆ ਇੱਕ ਘੁੰਮਣ ਵਾਲੀ ਜਗ੍ਹਾ ਹੈ ਆਪਾਂ ਬਹੁਤ ਘੁੰਮਣ ਫਿਰਨ ਉੱਥੇ ਗਏ ਸੀ ਅਤੇ ਆਪਾਂ ਜਿੰਨੇ ਦਿਨ ਵੀ ਉੱਥੇ ਰਹੇ ਹਾਂ ਆਪਾਂ ਬਹੁਤ ਜ਼ਿਆਦਾ ਇੰਜੋਏ ਕੀਤਾ ਅਤੇ ਬਹੁਤ ਵਧੀਆ ਆਨੰਦ ਆਇਆ ਹੈ ਅਤੇ ਆਪਾਂ ਚਾਵਾਂਗੇ ਆਪਾਂ ਦੁਬਾਰਾ ਜੇ ਮੌਕਾ ਮਿਲਿਆ ਤਾਂ ਆਪਾਂ ਮਨਸੂਰੀ ਵਿੱਚ ਬਹੁਤ ਦੁਬਾਰਾ ਜਾਣਾ ਬਹੁਤ ਪਸੰਦ ਕਰਾਂਗੇ